ਦਸ ਅਕਤੂਬਰ ਸੰਨ ਦੋ ਹਜ਼ਾਰ ਇੱਕ ਪੰਦਰ੍ਹਾਂ ਅਗਸਤ ਸੰਨ ਦੋ ਹਜ਼ਾਰ ਅਠਾਰ੍ਹਾਂ ਛੱਬੀ ਦਸੰਬਰ ਸੰਨ ਦੋ ਹਜ਼ਾਰ ਨੌ ਪੰਦਰ੍ਹਾਂ ਜੁਲਾਈ ਸੰਨ ਦੋ ਹਜ਼ਾਰ ਨੌ ਜਨਵਰੀ ਉੱਨੀ ਸੌ ਅੱਸੀ